ਘੁੰਮਣਾ ਫਿਰਨਾ ਮੇਰੀ ਸ਼ੁਰੂ ਤੋਂ ਹੀ ਹੋਬੀ ਹੈ ਇੱਕ ਜਦੋਂ ਵੀ ਮੈਨੂੰ ਕਿਤੇ ਮੌਕਾ ਮਿਲਦਾ ਤਾਂ ਮੈਂ ਘੁੰਮਣ ਫਿਰਨ ਜ਼ਰੂਰ ਜਾਂਦੀ ਹਾਂ ਪਰ ਇਨ ਫਿਊਚਰ ਮੈਂ ਸੋਚਾਂਗੀ ਕਿ ਮੈਂ ਪੰਜਾਬ ਤੋਂ ਬਾਹਰ ਵੀ ਘੁੰਮਣ ਫਿਰਨ ਜਾਵਾਂ ਕਿਉਂਕਿ ਮੈਂ ਅਜੇ ਸਟੱਡੀ ਕਰ ਰਹੀ ਹਾਂ ਤਾਂ ਅਜੇ ਮੇਰਾ ਕੋਈ ਪਲੈਨ ਨਹੀਂ ਬਣਦਾ ਸਕੂਲ ਤੋਂ ਵੀ ਛੁੱਟੀਆਂ ਨਹੀਂ ਮਿਲਦੀਆਂ ਬਹੁਤ ਘੱਟ ਹੁੰਦੀਆਂ ਤਾਂ ਜ਼ਿਆਦਾ ਕਰਕੇ ਮੈਂ ਟਰੈਵਲਿੰਗ ਜੋ ਕਿ ਆਪਣੇ ਨਾਨਕੇ ਜਾਂ ਭੂਆ ਦੇ ਹੋ ਕੇ ਜਾਂ ਮਾਸੀ ਦੇ ਜ਼ਿਆਦਾ ਜਾਂਦੀ ਹਾਂ ਜਾਂ ਫਿਰ ਕੋਈ ਹੋਰ ਰਿਸ਼ਤੇਦਾਰ ਦੇ ਚਲੀ ਜਾਂਦੀ ਹਾਂ ਜੋ ਕੋਈ ਹੁੰਦਾ ਹੈ ਫੰਕਸ਼ਨ ਵਗੈਰਾ ਪਰ ਜੇ ਦੇਖਿਆ ਜਾਵੇ ਤਾਂ ਮੈਨੂੰ ਨਾ ਇੱਕ ਹਿਸਟਰੀ ਦਾ ਬਹੁਤ ਸ਼ੌਕ ਹੈ ਕਿਤੇ ਵੀ ਜਾਵਾਂ ਤਾਂ ਮੈਂ ਉੱਥੋਂ ਦੀ ਹਿਸਟਰੀ ਜ਼ਰੂਰ ਲੈਂਦੀ ਹਾਂ ਕਿਉਂਕਿ ਜੇਕਰ ਆਪਾਂ ਜਾਂਦੇ ਹਾਂ ਤਾਂ ਘੁੰਮ ਫਿਰ ਕੇ ਆਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਸਦੀ ਹਿਸਟਰੀ ਪਤਾ ਹੋਣੀ ਚਾਹੀਦੀ ਕਿ ਉਸਦੀ ਹਿਸਟਰੀ ਕੀ ਸੀ ਅਤੇ ਮੈਂ ਸੋਚਾਂਗੀ ਜੇ ਇਨ ਫਿਊਚਰ ਮੈਂ ਆਪਣੀ ਸਟੱਡੀ ਪੂਰੀ ਕਰਕੇ ਕਿਤੇ ਬਾਹਰ ਵੀ ਘੁੰਮਣ ਜਾਵਾਂ